ਸਤਿ ਸ਼੍ਰੀ ਅਕਾਲ ਭਾਜੀ ਜਿਹੜਾ ਮੈਂ ਥੋਤੋਂ ਫ਼ੋਨ ਲੈਕੇ ਗਈ ਸੀ ਓਹਦਾ ਚਾਰਜਿੰਗ ਦੀ ਬੜੀ ਪ੍ਰੋਬਲਮ ਆ ਰਹੀ ਹੈ ਅਤੇ ਇਹਦੇ ਵਿੱਚ ਜਿਹੜੀ ਆਵਾਜ਼ ਵੀ ਹੈ ਉਹ ਕਲੀਅਰ ਨਹੀਂ ਸੁਣਾਈ ਦਿੰਦੀ ਅਤੇ ਜਦੋਂ ਅਸੀਂ ਕਾਲ ਵੀ ਕਰਦੇ ਹਾਂ ਅਤੇ ਬੈਕ ਕਾਲ ਉਹ ਟੱਚ ਹੈ ਜਿਹੜੀ ਇਹਦੀ ਉਹ ਵਧੀਆ ਨਹੀਂ ਹੈ ਅਤੇ ਟੱਚ ਜਦੋਂ ਅਸੀਂ ਕਾਲ ਕਿਸੇ ਦੀ ਆਉਂਦੀ ਹੈ ਜਾਂ ਕੱਟਣੀ ਹੁੰਦੀ ਹੈ ਕਾਲ ਕਰਕੇ ਉਹ ਕਾਲ ਉੱਥੇ ਫ਼ੋਨ ਹੈ ਜਿਹੜਾ ਹੈਂਗ ਹੋ ਜਾਂਦਾ ਹੈ ਅਤੇ ਚਾਰਜ ਲਗਾਂਦੇ ਹੈ ਕਦੇ ਇਹਦੇ ਪਿੰਨ ਹੈ ਜਿਹੜਾ ਉਹਦੇ 'ਚ ਪ੍ਰੋਬਲਮ ਹੋ ਜਾਂਦੀ ਜੇ ਕੁਛ ਸੇਵ ਕਰਦੇ ਹੈ ਉਹਦੇ ਵਿੱਚ ਵੀ ਨਹੀਂ ਅਤੇ ਸੈਲਫੀ ਵੀ ਨਹੀਂ ਵਧੀਆ ਆਉਂਦੀ ਹੈ ਅਤੇ ਇਹਦੇ ਕੈਮਰੇ ਵਿੱਚ ਜਦੋਂ ਅਸੀਂ ਫੋਟੋਆਂ ਵੀ ਬੈਕ ਕੈਮਰਾ ਅਤੇ ਫਰੰਟ ਕੈਮਰਾ ਦੋਨਾਂ ਵਿੱਚ ਬਹੁਤ ਪ੍ਰੋਬਲਮ ਹੈ ਅਤੇ ਇਹਦੀ ਜਿਹੜਾ ਚਾਰਜਰ ਇਹਦੀ ਜਲਦੀ ਉੱਡ ਜਾਂਦੀ ਹੈ ਅਤੇ ਇਹਨੂੰ ਦਸ ਦਸ ਮਿੰਟ ਬਾਅਦ ਚਾਰਜਰ ਲਗਾਉਣਾ ਪੈਂਦਾ ਹੈ ਜਿਹਦੇ ਕਰਕੇ ਫ਼ੋਨ ਬੜਾ ਹੀ ਮਤਲਬ ਕਿ ਉਹ ਹੈ ਬਹੁਤ ਖਰਾਬ ਹੈ